ਮੈਨੂੰ ਦਸਵੀਂ ਤੋਂ ਮਹਿਸੂਸ ਹੋਇਆ ਕਿ ਮੈਂ ਚੰਗੀ ਤਰ੍ਹਾਂ ਸਿਲਾਈ ਬੁਣਾਈ ਕਰਨ ਲੱਗ ਚੁੱਕੀ ਹਾਂ ਅਤੇ ਇਸ ਲਈ ਮੈਨੂੰ ਮੈਂ ਕੋਈ ਵੀ ਸਿਲਾਈ ਬਣਾਈ ਕਰਦੀ ਸੀ ਤਾਂ ਮੈਂ ਆਪਣੀ ਮਾਤਾ ਕੋਲ ਜਾਂਦੀ ਸੀ ਪਹਿਲਾਂ ਉਹਨਾਂ ਨੂੰ ਪੁੱਛਦੀ ਸੀ ਕਿ ਵੀ ਮੰਮੀ ਵੀ ਮੈਂ ਇਸ ਨੂੰ ਠੀਕ ਕੀਤਾ ਸਿਉਂ ਕੇ ਮੈਂ ਠੀਕ ਬਣਾਇਆ ਜਾਂ ਮੈਂ ਆਪਦੀ ਸਕੂਲ ਟੀਚਰ ਕੋਲ ਜਦੋਂ ਸੂਬਾਹ ਸਕੂਲ ਜਾਂਦੀ ਸੀ ਤਾਂ ਉਹਨਾਂ ਕੋਲੋਂ ਪੁੱਛਦੀ ਸੀ ਵੀ ਮੈਮ ਵੀ ਮੈਂ ਇਹ ਕੰਮ ਠੀਕ ਕੀਤਾ ਕੋਈ ਬੁਣਤੀ ਪਾਉਣਾ ਕੋਈ ਕਟਾਈ ਕਰਨਾ ਕੋਈ ਸਿਲਾਈ ਕਰਨਾ ਮੈਂ ਆਪਣੇ ਮੈਡਮ ਤੋਂ ਅਤੇ ਆਪਣੇ ਮਾਤਾ ਤੋਂ ਬਿਨਾਂ ਦੂਸਰੇ ਤੋਂ ਕਿਸੇ ਤੋਂ ਨਹੀਂ ਪੁੱਛਿਆ ਉਸ ਤੋਂ ਬਾਅਦ ਜਦੋਂ ਵੀ ਮੈਂ ਸੂਟ ਸਿਉਂਤਾ ਜਾਂ ਕੋਈ ਬੁਣਾਈ ਕੀਤੀ ਤਾਂ ਕਿਸੇ ਨੇ ਕਦੇ ਕੋਈ ਮੇਰੇ ਸੂਟ ਸਿਉਂਤੇ ਹੋਏ 'ਚ ਜਾਂ ਬੁਣਾਈ ਕਰੀ ਹੋਈ 'ਚ ਕਦੇ ਕੋਈ ਗਲਤੀ ਨਹੀਂ ਕੱਢੀ ਉਹਨਾਂ ਨੇ ਆਪਣੇ ਆਪ ਹੀ ਕਹਿ ਦਿੱਤਾ ਵੀ ਸਭ ਠੀਕ ਹੈ ਕਦੇ ਵੀ ਮੈਨੂੰ ਮਹਿਸੂਸ ਵੀ ਨਹੀਂ ਹੋਇਆ ਦੂਸਰਿਆਂ ਤੋਂ ਪੁੱਛਣ ਲਈ ਵੀ ਇਹ ਠੀਕ ਹੈ ਜਾਂ ਗਲਤ ਹੈ ਇਸ ਲਈ ਮੈਨੂੰ ਬਹੁਤ ਆਪਣੀ ਮਾਤਾ ਜੀ 'ਤੇ ਮਾਣ ਸੀ ਇਹ ਜਿਹਨਾਂ ਨੇ ਮੈਨੂੰ ਪੂਰਾ ਵਧੀਆ ਸਿਖਾਇਆ ਅਤੇ ਮੈਨੂੰ ਮੇਰੀ ਮੈਡਮ 'ਤੇ ਵੀ ਮਾਣ ਸੀ ਵੀ ਜਿਹਨਾਂ ਨੇ ਮੈਨੂੰ ਕਟਾਈ ਕਰਨ ਵਿੱਚ ਪੂਰਾ ਮੇਰੀ ਮਦਦ ਕੀਤੀ ਅਤੇ ਪੂਰਾ ਵਧੀਆ ਤਰੀਕੇ ਨਾਲ ਸਿਖਾਇਆ ਹੁਣ ਵੀ ਮੈਨੂੰ ਕਦੇ ਕਦੇ ਐਂ ਲੱਗਦਾ ਹੈ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਕਦੋਂ ਸਿਲਾਈ ਕਢਾਈ ਸਿੱਖ ਗਈ ਮੈਂ ਪੜਦਿਆਂ ਪੜ੍ਹਦਿਆਂ ਹੀ ਆਪਣਾ ਸਾਰਾ ਕੰਮ ਸਿੱਖ ਲਿਆ ਅਤੇ ਮੈਨੂੰ ਹਜੇ ਵੀ ਕੋਈ ਦਿੱਕਤ ਨਹੀਂ ਆਉਂਦੀ ਕੰਮ ਕਰਨ ਵਿੱਚ ਅਤੇ ਨਾ ਹੀ ਮੇਰਾ ਬਣਾਇਆ ਕਿਸੇ ਨੇ ਕੰਮ ਨਿੰਦਿਆ ਹੈ ਅਤੇ ਮੈਂ ਆਪਣੇ ਬੱਚਿਆਂ ਤੋਂ ਵੀ ਪੁੱਛਦੀ ਹਾਂ ਕਿ ਤੁਹਾਨੂੰ ਵਧੀਆ ਲੱਗਦਾ ਹੈ ਉਹ ਕਹਿ ਦਿੰਦੇ ਹਾਂ ਮੰਮੀ ਸਾਨੂੰ ਤੁਹਾਡੇ ਕੱਪੜੇ ਸਿਉਂਤੇ ਬਹੁਤ ਵਧੀਆ ਲੱਗਦੇ ਹਨ ਅਤੇ ਇਸ ਲਈ ਮੈਨੂੰ ਆਪਣੇ ਸਿਲਾਈ ਕਢਾਈ 'ਤੇ ਪੂਰਾ ਮਾਣ ਹੈ ਅਤੇ ਮੇਰੀ ਮਾਤਾ ਔਰ ਮੇਰੀ ਮੈਮ 'ਤੇ ਵੀ ਮੈਨੂੰ ਪੂਰਾ ਮਾਣ ਹੈ